ਆਧੁਨਿਕ ਯੁੱਗ ਵਿੱਚ ਜਾਨਵਰਾਂ ਨੂੰ ਚਰਾਉਣ ਲਈ ਕੋਈ ਖ਼ਾਸ ਹਰੇ ਉਪਲੱਬਧ ਨਹੀਂ ਹਨ ਅੱਜ ਦੇ ਸਮੇਂ ਵਿੱਚ ਰੁੱਖਾਂ ਨੂੰ ਲਗਾਤਾਰ ਕੱਟਿਆ ਜਾ ਰਿਹਾ ਹੈ ਜਿਸ ਕਾਰਣ ਜਾਨਵਰਾਂ 'ਤੇ ਬਹੁਤ ਬੁਰਾ ਪ੍ਰਭਾਵ ਪੈ ਰਿਹਾ ਹੈ ਅੱਜ ਦੇ ਦਿਨ ਵਿੱਚ ਤੁਸੀਂ ਦੇਖ ਸਕਦੇ ਹਾਂ ਕਿ ਹਰ ਘਰ ਵਿੱਚ ਏ ਸੀ ਲੱਗਾ ਰਿਹਾ ਹੋਇਆ ਹੈ ਚਾਹੇ ਉਹ ਸ਼ਹਿਰ ਹੈ ਜਾਂ ਪਿੰਡ ਹੈ ਜਿਸ ਕਰਕੇ ਵਾਤਾਵਰਨ ਦਾ ਤਾਪਮਾਨ ਬਹੁਤ ਤੇਜ਼ੀ ਨਾਲ ਵੱਧਦਾ ਜਾ ਰਿਹਾ ਹੈ ਅਤੇ ਗਲੋਬਲ ਵਾਰਮਿੰਗ ਦਾ ਕਾਫ਼ੀ ਖਤਰਾ ਬਣ ਚੁੱਕਿਆ ਹੈ ਪੰਛੀਆਂ ਦੀਆਂ ਕਈ ਕਿਸਮਾਂ ਵੀ ਅਲੋਪ ਹੋ ਰਹੀਆਂ ਹਨ ਜਦੋਂ ਦੇ ਹਰ ਘਰ ਵਿੱਚ ਮੋਬਾਇਲ ਆ ਗਏ ਹਨ ਮਨੁੱਖ ਆਪਣੀ ਜ਼ਿੰਦਗੀ ਨੂੰ ਸੌਖਾ ਕਰ ਰਿਹਾ ਹੈ ਪਰੰਤੂ ਕੁਰ ਕੁਦਰਤੀ ਜੀਵਾਂ ਦੀ ਜ਼ਿੰਦਗੀ ਕਾਫ਼ੀ ਖਤਰੇ ਵਿੱਚ ਹੈ ਪਾਣੀ ਦੀ ਦੁਰਵਰਤੋਂ ਵੀ ਤਲਾਬ ਛੱਪੜ ਝੀਲਾਂ ਦੇ ਖਤਮ ਹੋਣ ਨਾਲ ਜੀਵ ਨੂੰ ਪਾਣੀ ਵੀ ਸਾਫ਼ ਨਹੀਂ ਮਿਲ ਰਿਹਾ ਜਿਸ ਕਾਰਣ ਉਹਨਾਂ ਨੂੰ ਕਾਫ਼ੀ ਖਤਰਾ ਮੁੱਲ ਲੈਣਾ ਪੈ ਰਿਹਾ ਹੈ ਪਲਾਸਟਿਕ ਵੀ ਇੱਕ ਅਜਿਹੀ ਚੀਜ਼ ਹੈ ਜੋ ਕਿ ਨਾ ਗਲਦੀ ਹੈ ਅਤੇ ਨਾ ਖਤਮ ਹੁੰਦੀ ਹੈ ਜਿਸ ਕਾਰਣ ਇਹ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਵੀ ਕਾਫ਼ੀ ਅਸਰ ਪਾਉਂਦੀ ਹੈ ਕਾਰਖ਼ਾਨਿਆਂ ਦੇ ਵਿੱਚੋਂ ਵੀ ਜੋ ਜਹਿਰੀਲੇ ਪਦਾਰਥ ਦੂਸ਼ਿਤ ਪਾਣੀ ਕਰ ਰਹੇ ਹਨ ਜੋ ਪਾਣੀ ਦੇ ਵਿੱਚ ਸੁੱਟੀ ਜਾ ਰਹੇ ਹਨ ਅਤੇ ਨਦੀਆਂ ਦਰਿਆਵਾਂ ਆਦਿ ਨੂੰ ਕਾਫ਼ੀ ਗੰਦਾ ਕਰ ਰਹੇ ਹਨ ਜੋ ਕਿ ਸਾਡੇ ਲਈ ਇੱਕ ਬਹੁਤ ਹੀ ਸ਼ਰਮ ਵਾਲੀ ਗੱਲ ਹੈ ਜਿਸ ਕਾਰਨ ਬੇਜ਼ੁਬਾਨ ਜੰਗਲੀ ਜੀਵ ਕਾਫ਼ੀ ਖ਼ਤਰੇ ਵਿੱਚ ਹਨ ਇਸ ਚੀਜ਼ ਨੂੰ ਰੋਕਣਾ ਚਾਹੀਦਾ ਹੈ